ਪਾਣੀ ਨੂੰ ਫਿਲਟਰ ਕਰਨ ਅਤੇ ਸ਼ੁੱਧ ਕਰਨ ਲਈ ਅਸੀਂ ਘਰੇਲੂ ਇਲਾਜ਼ ਵਰਤਦੇ ਹਾਂ ਇਸ ਵਿੱਚ ਅਸੀਂ ਪਾਣੀ ਨੂੰ ਉਬਾਲ ਕੇ ਛਾਣ ਕੇ ਪੀਂਦੇ ਹਾਂ ਇਸ ਤੋਂ ਇਲਾਵਾ ਅਸੀਂ ਅਭਿਆਸ ਵਿੱਚ ਪਾਣੀ ਦੀ ਬਰਬਾਦੀ ਨਹੀਂ ਕਰਦੇ ਜਿੰਨਾ ਪਾਣੀ ਪੀਣਾ ਹੈ ਉੱਨਾ ਹੀ ਪਾਣੀ ਪੀਂਦੇ ਹਨ ਅਤੇ ਅਸੀਂ ਘੜੇ ਵਾਲੇ ਪਾਣੀ ਦੀ ਵਰਤੋਂ ਕਰਦੇ ਹਨ